ਭੰਗੜਾ ਪੰਜਾਬੀਆਂ ਦਾ ਪ੍ਰਮੁੱਖ ਲੋਕ ਨਾਚ ਹੈ ਇਹ ਪੰਜਾਬੀਆਂ ਦਾ ਮੁੱਖ ਅਤੇ ਮਨਪਸੰਦੀਦਾ ਲੋਕ ਨਾਚ ਹੈ ਭੰਗੜੇ ਦੇ ਕੁਝ ਸਟੈਪ ਹਨ ਜਿਹਨਾਂ ਦੀ ਵਰਤੋਂ ਪੰਜਾਬੀ ਭੰਗੜੇ ਨੂੰ ਪਾਉਣ ਸਮੇਂ ਕਰਦੇ ਹਨ ਇਹ ਸਟੈਪ ਹਨ ਲੁੱਡੀ ਧਮਾਲ ਜੁੱਤੀ ਹਾਥੀ ਚਾਲ ਝੂੰਮਰ ਅਤੇ ਕਿੱਕਲੀ ਇਹ ਸਟੈਪ ਆਮ ਤੌਰ 'ਤੇ ਹਰੇਕ ਭੰਗੜਾ ਪ੍ਰੋਗਰਾਮ ਵਿੱਚ ਪਾਏ ਜਾਂਦੇ ਹਨ ਇਹ ਭੰਗੜਾ ਪ੍ਰੋਗਰਾਮ ਚਾਹੇ ਕੋਈ ਵੀ ਹੋਵੇ ਸਕੂਲਾਂ ਵਿੱਚ ਕਾਲਜਾਂ ਵਿੱਚ ਕੋਈ ਵੀ ਸਮਾਰੋਹ ਹੋਵੇ ਇਹ ਸਟੈਪਾਂ ਦੀ ਵਰਤੋਂ ਕਰਕੇ ਹੀ ਭੰਗੜਾ ਲੋਕ ਨਾਚ ਨੂੰ ਪੂਰਾ ਕੀਤਾ ਜਾਂਦਾ ਹੈ ਇਹ ਸਟੈਪ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਨੂੰ ਦਰਸ਼ਾਉਂਦੇ ਹਨ ਕਿਉਂਕਿ ਪੰਜਾਬੀਆਂ ਦਾ ਸੁਭਾਅ ਕਾਫੀ ਜਸ਼ਨ ਮਨਾਉਣ ਵਾਲਾ ਅਤੇ ਖੁੱਲ੍ਹਾ ਡੁੱਲਾ ਹੁੰਦਾ ਹੈ ਇਸ ਤਰ੍ਹਾਂ ਇਹ ਕਾਫੀ ਜ਼ੋਰਦਾਰ ਤਰੀਕੇ ਨਾਲ ਆਪਣੀ ਖੁਸ਼ੀ ਮਨਾਉਂਦੇ ਹਨ ਇਸ ਕਰਕੇ ਇਹ ਸਟੈਪ ਵੀ ਕਾਫੀ ਜ਼ੋਰਦਾਰ ਅਤੇ ਸਰੀਰ ਖੋਲ੍ਹ ਕੇ ਨੱਚਣ ਵਾਲੇ ਹਨ ਇਹ ਸਟੈਪ ਕਾਫੀ ਜ਼ੋਰ ਨਾਲ ਅਤੇ ਬਹੁਤ ਜੋਸ਼ ਨਾਲ ਪਾਏ ਜਾਂਦੇ ਹਨ ਜੋ ਕਿ ਪੰਜਾਬੀਆਂ ਦਾ ਸੁਭਾਅ ਹੈ ਇਹ ਸਟੈਪ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਉਹਨਾਂ ਦੇ ਹਸਮੁਖ ਸੁਭਾਅ ਅਤੇ ਉਹਨਾਂ ਦੇ ਹਸਮੁਖ ਬਿਰਤੀ ਨੂੰ ਦਰਸਾਉਂਦੇ ਹਨ ਪੰਜਾਬੀ ਇਹਨਾਂ ਸਟੈਪਾਂ ਵਾਂਗ ਹਰ ਖੁਸ਼ੀ ਪੂਰੇ ਜੋਸ਼ ਨਾਲ ਨੱਚ ਕੁੱਦ ਕੇ ਮਨਾਉਂਦੇ ਹਨ ਇਹਨਾਂ ਸਟੈਪਾਂ ਵਿੱਚ ਪੰਜਾਬੀਆਂ ਦਾ ਜ਼ੋਰਦਾਰ ਜਸ਼ਨ ਉਹਨਾਂ ਦਾ ਸੱਭਿਆਚਾਰ ਸਪਸ਼ਟ ਰੂਪ ਵਿੱਚ ਦਿਖਾਈ ਦਿੰਦਾ ਹੈ ਭੰਗੜਾ ਲੋਕ ਨਾਚ ਪੰਜਾਬੀਆਂ ਦਾ ਇੱਕ ਅਜਿਹਾ ਲੋਕ ਨਾਲ ਹੈ ਜਿਸ ਵਿੱਚ ਉਹਨਾਂ ਦਾ ਸੱਭਿਆਚਾਰ ਸਪਸ਼ਟ ਰੂਪ ਵਿੱਚ ਦਿਖਾਈ ਦਿੰਦਾ ਹੈ